ਨੌਜਵਾਨਾਂ ਦੇ ਵਿੱਚ ਬੇਰੁਜ਼ਗਾਰੀ ਬਹੁਤ ਬੜਾ ਮੁੱਦਾ ਹੈ ਪੰਜਾਬ ਦੇ ਵਿੱਚ ਕਈ ਅਸੀਂ ਦੇਖਦੇ ਹਾਂ ਪਿੰਡਾਂ ਵਿੱਚ ਪਿੰਡਾਂ ਦੇ ਵਿੱਚ ਪੇਂਡੂਆਂ ਦੇ ਮੁੰਡੇ ਇਹ ਬਹੁਤ ਜ਼ਿਆਦਾ ਨਸ਼ੇ ਦੇ ਵਿੱਚ ਪਏ ਹੋਏ ਹਨ ਉਹ ਨਸ਼ੇ ਦੇ ਵਿੱਚ ਪੈ ਕੇ ਉਹਦੇ ਵਿੱਚ ਲਾਲਚ ਆ ਕੇ ਲੋਕਾਂ ਦੀਆਂ ਕਈ ਵਾਰੀ ਤੁਸੀਂ ਦੇਖਦੇ ਹੋ ਕਿ ਬਹੁਤ ਜ਼ਿਆਦਾ ਚੋਰੀਆਂ ਚਕਾਰੀਆਂ ਹੁੰਦੀਆਂ ਹਨ ਨਸ਼ੇ ਦੇ ਚੱਕਰ 'ਚ ਉਹਨਾਂ ਨੂੰ ਗੌਰਵ ਚੋਰੀਆਂ ਚਕਾਰੀਆਂ ਤੋਂ ਹੱਟ ਕੇ ਆਪਣਾ ਕੋਈ ਕੰਮ ਵੱਲ ਧਿਆਨ ਦੇਣਾ ਚਾਹੀਦਾ ਜਿਹਦੇ ਜੇ ਕੰਮ 'ਚ ਰੁੱਝਣਗੇ ਤਾਂ ਆਪੇ ਉਹਨਾਂ ਦਾ ਧਿਆਨ ਗਲਤ ਵੱਲ ਗੱਲਾਂ ਵੱਲ ਨਹੀਂ ਜਾਏਗਾ ਅਗੌਰਮਿੰਟ ਨੂੰ ਵੀ ਚਾਹੀਦਾ ਕਿ ਨਵੀਆਂ ਨਵੀਆਂ ਕੋਈ ਨਾ ਕੋਈ ਨੌਕਰੀਆਂ ਕੱਢਣੀਆਂ ਚਾਹੀਦੀਆਂ ਹਨ ਜਿਹਦੇ ਵਿੱਚ ਜਿਹਨਾਂ ਉਹਨਾਂ ਲੋਕਾਂ ਦੇ ਘਰਾਂ ਦੀ ਰੋਟੀ ਚੱਲ ਸਕੇ ਸਾਨੂੰ ਵਿਹਲੇ ਬੈਠਣਾ ਨਹੀਂ ਚਾਹੀਦਾ ਕੁਛ ਨਾ ਕੁਛ ਸੋਚਣਾ ਚਾਹੀਦਾ ਕਿ ਅਸੀਂ ਕਿਸ ਤਰ੍ਹਾਂ ਘਰ ਦੇ ਵਿੱਚ ਪੈਸੇ ਲਿਆ ਸਕਦੇ ਹਾਂ ਲੇਕਿਨ ਅੱਜ ਕੱਲ੍ਹ ਜਿਹੜੇ ਨਵੇਂ ਨੌਜਵਾਨ ਨੇ ਉਹ ਨਸ਼ੇ ਦੇ ਚੱਕਰ ਦੇ ਵਿੱਚ ਆਪਣਾ ਆਪਣੀ ਲਾਈਫ਼ ਪੂਰੀ ਖ਼ਰਾਬ ਕਰ ਰਹੇ ਹਨ ਔਰ ਉਹਨਾਂ ਨੂੰ ਚਾਹੀਦਾ ਹੈ ਕਿ ਜਿੱਥੇ ਉਹਨਾਂ ਨੂੰ ਕੋਈ ਸਕੋਪ ਮਿਲਦਾ ਹੈ ਉਹ ਜ਼ਰੂਰ ਟ੍ਰਾਈ ਕਰਨ ਕੰਮ ਕਰਨ 'ਚ ਕੋਈ ਵੀ ਕੋਈ ਵੀ ਬੰ ਛੋਟਾ ਨਹੀਂ ਹੋ ਜਾਂਦਾ ਕੰਮ ਕਰਨ ਦੇ ਵਿੱਚ ਬੰਦੇ ਨੂੰ ਨੌਲੇਜ ਵੱਧਦੀ ਹੈ ਔਰ ਕੰਮ 'ਚ ਰੁੱਝੇ ਹੋਏ ਹੋਏ ਬੰਦੇ ਨੂੰ ਆ ਧਿਆਨ ਆਪੇ ਗਲਤ ਕੰਮਾਂ ਵਿੱਚ ਨਹੀਂ ਜਾਂਦਾ ਅੱਜ